ਪਹਿਲੇ ਸਮੇਂ ਵਿੱਚ ਸਰਕਾਰ ਨੇ ਕੋਈ ਵੀ ਅਜਿਹੀ ਸਕੀਮ ਨਹੀਂ ਚਾਲੂ ਕੀਤੀ ਅਤੇ ਬੱਚਿਆ ਲਈ ਜੋ ਸਕੂਲਾਂ ਵਿੱਚ ਕੁਝ ਖਾਣ ਨੂੰ ਮਿਲੇ ਜਿਸ ਕਾਰਨ ਬੱਚਿਆਂ ਨੂੰ ਬਹੁਤ ਬਿਮਾਰੀਆਂ ਲੱਗਦੀਆਂ ਸਨ ਅਤੇ ਹੁਣ ਸਮੇਂ ਵਿੱਚ ਪ੍ਰਧਾਨ ਮੰਤਰੀ ਨੇ ਪੋਸ਼ਣ ਯੋਜਨਾ ਸ਼ੁਰੂ ਕੀਤੀ ਹੈ ਜਿਸ ਵਿੱਚ ਛੋਟੇ ਬੱਚਿਆਂ ਨੂੰ ਆਂਗਣਵਾੜੀ ਵਿੱਚ ਦਲੀਆ ਮਿਲਦਾ ਹੈ ਸਰੀਰ 'ਚ ਚੰਗੇ ਲਈ ਅਤੇ ਮਿਡ ਡੇ ਮੀਲ ਬੱਚਿਆਂ ਨੂੰ ਪਹਿਲੀ ਅਤੇ ਅੱਠਵੀਂ ਤੱਕ ਸਕੂਲਾਂ ਵਿੱਚ ਦਿੱਤਾ ਜਾਂਦਾ ਹੈ ਜੋ ਕਿ ਸਰੀਰ ਤਾਕਤਵਰ ਹੁੰਦਾ ਹੈ ਅਤੇ ਸਰਕਾਰ ਨੇ ਬਹੁਤ ਵਧੀਆ ਇਹ ਯੋਜਨਾ ਕੀਤੀ ਅਤੇ ਇਸ ਨਾਲ ਸਾਡੇ ਬੱਚਿਆਂ ਵਿੱਚ ਬਿਮਾਰੀਆਂ ਵੀ ਘ ਘਟੀਆਂ ਅਤੇ ਪਹਿਲਾਂ ਬੱਚਿਆਂ ਨੂੰ ਬਹੁਤ ਬਿਮਾਰੀਆਂ ਲੱਗ ਜ ਲੱਗ ਜਾਂਦੀਆਂ ਸਨ ਅਤੇ ਹੁਣ ਬਿਲਕੁਲ ਬਿਮਾਰੀਆਂ ਖਤਮ ਹੋ ਗਈਆਂ ਸਰਕਾਰ ਨੇ ਦਾ ਬਹੁਤ ਵਧੀਆ ਇਹ ਉਪਰਾਲਾ ਹੈ